ਫਰਸਟ ਅਕਤੂਬਰ ਵੀਹ ਸੌ ਵੀਹ ਤਿੰਨ ਨਵੰਬਰ ਉੱਨੀ ਸੌ ਉਣਾਸੀ ਚਾਰ ਮਾਰਚ ਉੱਨੀ ਸੌ ਇਕਿਆਸੀ ਪੰਜ ਜੁਲਾਈ ਵੀਹ ਸੌ ਇੱਕੀ ਇੱਕ ਜਨਵਰੀ ਵੀਹ ਸੌ ਚੌਵੀ